ਮੈਂ ਆਪਣੇ ਇਲਾਕੇ ਦੇ ਸਕੂਲ ਬਾਰੇ ਦੱਸਣਾ ਚਾਹੁੰਦੀ ਹਾਂ ਮੈਂ ਸਨੋ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਪਟਿਆਲਾ ਜ਼ਿਲ੍ਹਾ ਦਾ ਤਹਿਸੀਲ ਅੰਦਰ ਆਉਂਦਾ ਹੈ ਅਤੇ ਮੇਰੇ ਸਕੂਲ ਦਾ ਨਾਮ ਸ ਹੈਗਾ ਸਰਕਾਰੀ ਗੌ ਗੌਰਮੈਂਟ ਗਰਲ ਸੀਨੀਅਰ ਸੈਕੈਂਡਰੀ ਸਕੂਲ ਅਤੇ ਮੈਂ ਅੱਜ ਜੋ ਵੀ ਹਾਂ ਮੈਂ ਇਸ ਸਕੂਲ ਦੇ ਕਰਕੇ ਹੀ ਹਾਂ ਅੱਜ ਇਹਨਾਂ ਦੇ ਜਿਹੜੇ ਟੀਚਰ ਨੇ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਪੜ੍ਹਾਇਆ ਹੈ ਅਤੇ ਉਹ ਬਹੁਤ ਹੀ ਐਜੂਕੇਟਡ ਟੀਚਰ ਨੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਹੁੰਦਾ ਕਿ ਟੀਚਰ ਐਜੂਕੇਟਡ ਹੋਣਗੇ ਬਹੁਤ ਮਿਹਨਤੀ ਹੋਣਗੇ ਬੜੀਆਂ ਮਿਹਨਤਾਂ ਕਰਕੇ ਫਿਰ ਹੀ ਉਹ ਸਰਕਾਰੀ ਟੀਚਰ ਲੱਗਦੀ ਹੈ ਇਸ ਕਰਕੇ ਮੈਂ ਕਹਿੰਦੀ ਹਾਂ ਕਿ ਜਿੰਨਾ ਜ਼ਿਆਦਾ ਟੀਚਰ ਵਧੀਆ ਪੜ੍ਹਿਆ ਐਜੂਕੇਟਡ ਹੋਏਗਾ ਓਨਾ ਜ਼ਿਆਦਾ ਤੁਹਾਨੂੰ ਅੱਛੇ ਤਰੀਕੇ ਨਾਲ ਪੜ੍ਹਾ ਸਕਦਾ ਹੈ ਅਤੇ ਇਹ ਟੀਚਰ ਹੁੰਦੇ ਨੇ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਹੁੰਦੇ ਹੈ ਇਹ ਤੁਹਾਡੀ ਜਿਹੜੀ ਗੁਣਵੱਤਾ ਹੈ ਇਹਨੂੰ ਵਧਾਉਣ 'ਚ ਵੀ ਤੁਹਾਡੀ ਹੈਲਪ ਕਰਦੀਆਂ ਨੇ ਅਤੇ ਜਿਹੜੇ ਵੱਡੇ ਸਕੂਲਾਂ ਦੇ ਹੁੰਦੇ ਨੇ ਉਹ ਮੈਂ ਕਹਿ ਸਕਦੀ ਹਾਂ ਅਤੇ ਸ਼ਹਿਰਾਂ ਦੇ ਸਕੂਲ ਹੁੰਦੇ ਨੇ ਉਹ ਥੋੜ੍ਹੇ ਇੰਗਲਿਸ਼ ਮਤਲਬ ਉਹ ਲਗਾਉਂਦੇ ਸਿਰਫ ਉਹ ਨੇ ਕਿ ਉੱਥੇ ਬੱਚੇ ਨੇ ਜਿਹੜੇ ਆਪਣੇ ਹਾਈ ਫਾਈ ਇੰਗਲਿਸ਼ ਸਿੱਖਣ ਸਿੱਖ ਸਕਣ ਇਸ ਕਰਕੇ ਉਹ ਤਜਵੀਜ਼ ਦਿੰਦੇ ਨੇ ਸ਼ਹਿਰਾਂ ਦੇ ਸਕੂਲਾਂ ਨੂੰ ਇਸ ਤੋਂ ਇਲਾਵਾ ਮੈਂ ਕਹਿੰਦੀ ਹਾਂ ਕਿ ਜੇਕਰ ਤੁਸੀਂ ਆਪਣੇ ਬੱਚੇ ਦੇ ਮਾਇੰਡ ਨੂੰ ਵਧੀਆ ਡੈਵੋਲਪ ਕਰਨਾ ਤਾਂ ਤੁਸੀਂ ਆਪਣੇ ਜਿਹੜੇ ਸ ਪਿੰਡਾਂ ਦੇ ਸਕੂਲ ਨੇ ਉਹਨਾਂ 'ਚ ਪੜਾਓ ਅਤੇ ਮੈਂ ਤਾਂ ਵੈਸੇ ਆਪਣੇ ਸਕੂਲ 'ਚ ਜਿਸ 'ਚ ਪੜ੍ਹੀ ਹੋਈ ਹਾਂ ਸਰਕਾਰੀ ਸੀਨੀਅਰ ਗਰਲ ਸਕੂਲ ਸਕੈਂਡਰੀ ਸਕੂਲ ਦੇ ਵਿੱਚ ਉਸ ਤੋਂ ਮੈਂ ਸੰਤੁਸ਼ਟ ਹਾਂ